ਪੰਜਾਬ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਇਸ 'ਤੇ ਮੈਂ ਇੱਕ ਪੱਖ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਇੱਥੇ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਨੇ ਉਹਨਾਂ ਦੀ ਪੜ੍ਹਾਈ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਮੈਂ ਆਪਣੇ ਹੀ ਸਕੂਲ 'ਚ ਦੇਖਦੀ ਹਾਂ ਵੀ ਜਿਹੜੇ ਬੱਚੇ ਥੋੜ੍ਹੇ ਜਿਹੇ ਦਿਮਾਗੀ ਤੌਰ 'ਤੇ ਜਾਂ ਕਿਸੇ ਸ਼ਰੀਰਕ ਤੌਰ 'ਤੇ ਜਾਂ ਕਿਸੇ ਹੋਰ ਪੱਖੋਂ ਥੋੜ੍ਹੇ ਕਮਜ਼ੋਰ ਨੇ ਤਾਂ ਉਹਨਾਂ ਨੂੰ ਉਸ ਤਰ੍ਹਾਂ ਦੀ ਸਿੱਖਿਆ ਦੇ ਕੇ ਅਤੇ ਕਿਰਤ ਕਰਨ ਦੀ ਨਾਲ਼ ਸਿੱਖਿਆ ਦੇ ਕੇ ਉਹਨਾਂ ਦੀ ਜਿਹੜੀ ਸਮੱਸਿਆ ਉਹ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਹ ਮੈਨੂੰ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਜ਼ਿਆਦਾ ਵਧੀਆ ਉਪਰਾਲਾ ਲੱਗਿਆ